ਮੈਂ ਤੁਹਾਡੀ ਐਕਸ ਵਾਈ ਜੇਡ ਵੈਬਸਾਈਟ ਤੋਂ ਰਨਿੰਗ ਸੂਜ ਔਡਰ ਕਰਵਾਏ ਸਨ ਮੈਂ ਇੱਕ ਖਿਡਾਰੀ ਹਾਂ ਅਤੇ ਮੈਂ ਸੌ ਮੀਟਰ ਦੌੜ ਵਿੱਚ ਹਿੱਸਾ ਲਿਆ ਸੀ ਜਿਸ ਲਈ ਮੈਂ ਤੁਹਾਡੇ ਤੋਂ ਕਿਊ ਜੈੱਡ ਕੰਪਨੀ ਦੇ ਰਨਿੰਗ ਸ਼ੂਜ ਮੰਗਵਾਏ ਸਨ ਮੈਨੂੰ ਤਿੰਨ ਦਿਨ ਪਹਿਲਾਂ ਹੀ ਔਡਰ ਪੁੱਜਾ ਅਤੇ ਜਦੋਂ ਮੈਂ ਔਡਰ ਦਾ ਪੈਕਜ ਖੋਲ੍ਹਿਆ ਉਸਦਾ ਡੱਬਾ ਅਲੱਗ ਅਤੇ ਟੈਗ ਅਲੱਗ ਸੀ ਪਰ ਮੈਨੂੰ ਇਹ ਦੇਖ ਕੇ ਬਹੁਤ ਹੀ ਨਿਰਾਸ਼ਾ ਹੋਈ ਪਰ ਮੈਨੂੰ ਤੁਹਾਡੇ ਦਿੱਤੇ ਉਹ ਬੂਟ ਪਾਣੇ ਪਏ ਕਿਉਂਕਿ ਉਸ ਦਿਨ ਮੇਰੀ ਟੂਰਨਾਮੈਂਟ ਸੀ ਮੈਂ ਤੁਹਾਡੇ ਦਿੱਤੇ ਗਏ ਸ਼ੂਜ਼ ਪਾਏ ਅਤੇ ਦੌੜ ਲਗਾਈ ਉਹ ਬੂਟ ਇੰਨੇ ਬੇਕਾਰ ਸਨ ਕਿ ਉਹਨਾਂ ਨੇ ਮੈਨੂੰ ਆਪਣੀ ਦੌੜ ਪੂਰੀ ਕਰਨ ਦਾ ਮੌਕਾ ਹੀ ਨਹੀਂ ਦਿੱਤਾ ਉਹ ਅੱਧ ਰਸਤੇ ਵਿੱਚ ਹੀ ਬੂਟ ਫਟ ਗਏ ਜਿਸ ਕਰਕੇ ਮੈਨੂੰ ਬਹੁਤ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਮੇਰੀ ਸਾਲ ਭਰ ਦੀ ਮਿਹਨਤ ਸਾਰੀ ਅਸਫਲ ਹੋ ਗਈ ਮੈਨੂੰ ਬਹੁਤ ਦੁੱਖ ਲੱਗਿਆ ਕਿ ਜਿਸ ਕੰਪਨੀ ਦੇ ਮੈਂ ਬੂਟ ਮੰਗਵਾਏ ਸੀ ਉਹ ਮੇਰੇ ਤੱਕ ਨਹੀਂ ਪੁੱਜੇ ਇਸ ਕਰਕੇ ਮੈਂ ਇਹ ਚਾਹੁੰਦਾ ਹਾਂ ਕਿ ਤੁਸੀਂ ਮੈਨੂੰ ਰਿਫੰਡ ਦਿਓ ਜਾਂ ਫਿਰ ਇਸ ਦੇ ਬਦਲੇ ਜਿਹੜੇ ਬੂਟ ਮੈਂ ਮੰਗਵਾਏ ਸੀ ਉਹ ਬੂਟ ਮੈਨੂੰ ਦਿੱਤੇ ਜਾਣ ਤਾਂ ਜੋ ਮੈਂ ਆਪਣਾ ਦੌੜ ਦਾ ਹਿੱਸਾ ਫਿਰ ਸ਼ੁਰੂ ਕਰ ਸਕਾਂ ਧੰਨਵਾਦ ਅਤੇ ਕੋਸ਼ਿਸ਼ ਕਰਿਓ ਕਿ ਅਗਲੀ ਵਾਰ ਇਹ ਗਲਤੀ ਨਾ ਹੋਵੇ